ਹੈਲੋ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਹੁਤ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਕਿੱਦਾਂ ਨੇ ਸਾਰੇ ਸਾਰੇ ਵਧੀਆ ਜੀ ਵਾਧੀ ਵਧੀਆ ਵਾਹਿਗੁਰੂ ਦੀ ਮਿਹਰ ਹੈ ਜੀ ਹਾਂਜੀ ਹਾਂਜੀ ਹੋਰ ਵਧੀਆ ਜੀ ਤੁਸੀਂ ਦੱਸੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜ਼ਰੂਰ ਜੇ ਤੁਸੀਂ ਸ਼ੋਪਿੰਗ ਕਰਨ ਜਾਣਾ ਆ ਵੈਸੇ ਤਾਂ ਮਾਨਸਾ 'ਚ ਹੀ ਬਹੁਤ ਸਾਰੇ ਮੌਲ ਹੈਗੇ ਆ ਅਤੇ ਸਪੈਸ਼ਲੀ ਜਿੱਥੇ ਮੈਂ ਬਹੁਤ ਵਾਰੀ ਜਾਂਦੀ ਦਾ ਗ੍ਰੈਂਡ ਮੌਲ ਆ ਜੀ ਮਾਨਸੇ 'ਚ ਜਿਸ 'ਚ ਬਹੁਤ ਵਧੀਆ ਵੀ ਕੰਪਨੀ ਦੀਆਂ ਬ੍ਰੈਂਡ ਦੀਆਂ ਚੀਜ਼ਾਂ ਮਿਲਦੀਆਂ ਜਿਵੇਂ ਸ਼ੂਜ਼ ਵਗੈਰਾ ਹੋ ਗਏ ਹੈ ਨਾ ਕਲੋਥਸ ਹੋ ਗਏ ਅਲੱਗ ਅਲੱਗ ਟਾਈਪ ਦੇ ਜਿਹੜੇ ਤੁਹਾਨੂੰ ਪਸੰਦ ਹੈ ਜਾਂ ਫੁੱਟਵੀਅਰਜ ਹੋ ਗਏ ਅਤੇ ਹੋਰ ਵੀ ਬਹੁਤ ਜ਼ਿਆਦੀਆਂ ਚੀਜ਼ਾਂ ਮੇਕਅੱਪ ਦਾ ਸਮਾਨ ਹੋ ਗਿਆ ਅਤੇ ਜਿਵੇਂ ਜਿਹੜੇ ਨਿੱਕੇ ਬੱਚੇ ਆ ਉਹਨਾਂ ਲਈ ਬਹੁਤ ਸਾਰੀਆਂ ਗੇਮਸ ਹੈਗੀਆਂ ਜਿਵੇਂ ਔਨਲਾਈਨਸ ਹੋ ਗਈਆਂ ਹੈ ਨਾ ਉੱਥੇ ਬੱਚੇ ਖੇਡ ਸਕਦੇ ਹੈਗੇ ਅਤੇ ਬਾਹਰ ਪਾਰਕਿੰਗ ਹੈਗਾ ਅਤੇ ਜਿੱਥੇ ਵੀ ਅਤੇ ਜੇ ਤੁਸੀਂ ਵੀ ਮੂਵੀ ਵਗੈਰਾ ਦੇਖਣੀ ਆ ਤਾਂ ਸਿਨੇਮਾ ਹੈਗਾ ਉੱਥੇ ਡਰੀਮ ਰਿਐਲਿਟੀ ਜਿਹੜੀ ਸਕਰੀਨ ਫੁੱਲ ਐੱਚ ਡੀ ਆ ਅਤੇ ਮਿਊਜ਼ਿਕ ਵਗੈਰਾ ਅਤੇ ਵੋਲੀਅਮ ਵਗੈਰਾ ਬਹੁਤ ਹੀ ਸਾਫ਼ ਆ ਅਤੇ ਉੱਥੇ ਜਾ ਕੇ ਤੁਹਾਨੂੰ ਬਹੁਤ ਮਜ਼ਾ ਆਊਗਾ ਤੁਸੀਂ ਕੋਈ ਵੀ ਮੂਵੀ ਦੇਖ ਸਕਦੇ ਹੋ ਅੱਜ ਕੱਲ੍ਹ ਜਿਹੜੀਆਂ ਲੇਟੈਸਟ ਮੂਵੀਆਂ ਆਈ ਆਈ ਹੋਈ ਹੈ ਉਹੀ ਲੱਗੀਆਂ ਹੋਈਆਂ ਉੱਥੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਗੱਲ ਤਾਂ ਹੈਗੀ ਆ ਜੇ ਆਪਾਂ ਕਿਤੇ ਨਵੇਂ ਨਵੇਂ ਜਾਈਏ ਆਪਾਂ ਨੂੰ ਕੁ ਨਹੀਂ ਪਤਾ ਹੁੰਦਾ ਅਤੇ ਪੁਛ ਪੁੱਛਣਾ ਚਾਹੀਦਾ ਆਪਾਂ ਨੂੰ ਹਰੇਕ ਚੀਜ਼ ਬਾਰੇ ਨੌਲੇਜ ਹੋਣੀ ਚਾਹੀਦੀ ਆ ਆਪਾਂ ਜਿੱਥੇ ਰਹਿੰਦੇ ਹਾਂ ਹਨਾ ਵੀ ਥੋੜ੍ਹਾ ਬਹੁਤਾ ਕਿਉਂਕਿ ਜੇ ਘਰੋਂ ਬਾਹਰ ਨਿਕਲਾਂਗੇ ਫੇਰ ਹੀ ਆਪਾਂ ਨੂੰ ਚੀਜ਼ਾਂ ਦਾ ਪਤਾ ਲੱਗੇਗਾ ਹੁਣ ਘਰ ਤਾਂ ਕੋਈ ਨਹੀਂ ਦੱਸਣ ਆਉਂਦਾ ਵੀ ਇੱਥੇ ਆਹ ਚੀਜ਼ ਹੈਗੀ ਆ ਇੱਥੇ ਉਹ ਚੀਜ਼ ਆ ਹੈ ਨਾ ਬਾਕੀ ਘੁੰਮੋ ਫਿਰੋ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਕਾਲ ਕਰੋ ਜਿਹੜਾ ਕੁਛ ਪੁੱਛਣਾ ਮੇਰੇ ਤੋਂ ਪੁੱਛੋ ਹਾਂ ਹਾਂਜੀ ਹਾਂਜੀ ਓਕੇ ਜੀ ਓਕੇ ਹਾਂਜੀ ਹਾਂਜੀ ਕਰੋ ਕਰੋ ਇੰਜੋਏ ਹੱਸਣ ਖੇਡਣ ਆਏ ਹਾਂ ਆਪਾਂ ਦੁਨੀਆ 'ਤੇ ਹਾਂਜੀ ਹਾਂਜੀ ਹਾਂਜੀ ਸਹੀ ਗੱਲ ਆ ਜੀ ਓ ਹਾਂਜੀ ਹਾਂਜੀ ਓਕੇ ਠੀਕ